ਸਤਿ ਸ਼੍ਰੀ ਅਕਾਲ ਸਰ ਹੋਰ ਸੁਣਾਓ ਕੀ ਹਾਲ ਚਾਲ ਹੈ ਜਿਵੇਂ ਕੀ ਥੋੜ੍ਹਾ ਟਾਈਮ ਪਹਿਲਾਂ ਮੈਂ ਤੁਹਾਡੇ ਕੋਲੋਂ ਇੱਕ ਔਡਰ ਕੀਤਾ ਸੀ ਪੀਜ਼ੇ ਦਾ ਮੈਂ ਔਡਰ ਕੀਤਾ ਸੀ ਅਤੇ ਉਸਦਾ ਭੁਗਤਾਨ ਉਸਦੀ ਪੇਮੈਂਟ ਮੈਂ ਔਨਲਾਈਨ ਕੀਤੀ ਸੀ ਫੋਨਪੇ ਰਾਹੀਂ ਅਤੇ ਉਸਦੀ ਜਦੋਂ ਮੈਂ ਪੇਮੈਂਟ ਕੀਤੀ ਤਾਂ ਉਸਦਾ ਕੋਈ ਵੀ ਮੈਨੂੰ ਸ਼ੋ ਦਿਖ ਨਹੀਂ ਰਿਹਾ ਕਿ ਉਹ ਪੇਮੈਂਟ ਸਫਲਤਾ ਪੂਰਵਕ ਹੋ ਚੁੱਕੀ ਹੈ ਜਾਂ ਨਹੀਂ ਮੈਂ ਪੇਮੈਂਟ ਤੁਹਾਨੂੰ ਔਡਰ ਕਰਨ ਲੱਗੇ ਔਨਲਾਈਨ ਉਸੀ ਟਾਈਮ ਹੀ ਕਰ ਦਿੱਤੀ ਸੀ ਜਿਸ ਟਾਈਮ ਮੈਂ ਔਡਰ ਦਿੱਤਾ ਸੀ ਤੁਹਾਨੂੰ ਪਰ ਉਸ ਭੁਗਤਾਨ ਦਾ ਮੇਰੇ ਕੋਲ ਕੋਈ ਵੀ ਪਰੂਫ ਨਹੀਂ ਆ ਰਿਹਾ ਜਾਂ ਕੋਈ ਵੀ ਸੂਚਨਾ ਉਸ ਦੀ ਨਹੀਂ ਆ ਰਹੀ ਕਿ ਉਹ ਭੁਗਤਾਨ ਸਫਲ ਹੋ ਗਿਆ ਹੈ ਜਾਂ ਨਹੀਂ ਮੈਂ ਆਪਣੇ ਫੋਨਪੇ ਵਿੱਚ ਵੀ ਦੇਖ ਲਿਆ ਹੈ ਕਿ ਉਸਦਾ ਕੋਈ ਉਸ ਭੁਗਤਾਨ ਦੇ ਸਫਲ ਹੋਣ ਦੀ ਕੋਈ ਸੂਚਨਾ ਉਸ ਵਿੱਚ ਦਿਖ ਰਹੀ ਹੈ ਜਾਂ ਨਹੀਂ ਪਰ ਫੋਨਪੇ ਵਿੱਚ ਵੀ ਦੇਖਣ ਤੋਂ ਬਾਅਦ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਇਸ ਲਈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਇਹ ਸਪੱਸ਼ਟੀਕਰਨ ਕਰਨਾ ਚਾਹੁੰਦੀ ਹਾਂ ਕਿ ਜਦੋਂ ਮੈਂ ਆਪਣਾ ਔਡਰ ਦਿੱਤਾ ਪੀਜ਼ੇ ਦਾ ਤਾਂ ਉਸਦੀ ਜੋ ਭੁਗਤਾਨ ਹੈ ਉਹ ਸਫ਼ਲਤਾਪੂਰਵਕ ਹੋ ਗਿਆ ਸੀ ਜਾਂ ਨਹੀਂ ਅਗਰ ਨਹੀਂ ਹੋਇਆ ਤਾਂ ਫਿਰ ਵੀ ਮੈਨੂੰ ਇਸ ਦੀ ਸੂਚਨਾ ਦਿੱਤੀ ਜਾਵੇ ਅਗਰ ਭੁਗਤਾਨ ਹੋ ਗਿਆ ਹੈ ਤਾਂ ਵੀ ਮੈਨੂੰ ਇਸ ਦੀ ਸੂਚਨਾ ਦਿੱਤੀ ਜਾਵੇ ਤਾਂ ਕਿ ਮੈਂ ਉਸ ਬਾਰੇ ਸੋਚ ਸਕਾਂ ਅਗਰ ਨਹੀਂ ਹੋਇਆ ਉਸਦਾ ਭੁਗਤਾਨ ਜਾਂ ਉਸ ਦੀ ਪੇਮੈਂਟ ਨਹੀਂ ਹੋਈ ਤਾਂ ਮੈਂ ਉਸਦੀ ਉਸਦਾ ਭੁਗਤਾਨ ਤੁਹਾਨੂੰ ਦੁਬਾਰਾ ਕਰ ਸਕਦੀ ਹਾਂ ਜਾਂ ਅਗਰ ਉਸਦੇ ਆ ਭੁਗਤਾਨ ਨਹੀਂ ਹੋਇਆ ਮੇਰੇ ਅਕਾਊਂਟ ਵਿੱਚੋਂ ਮੇਰੇ ਖਾਤੇ ਵਿੱਚੋਂ ਉਸਦੇ ਪੈਸੇ ਕੱਟ ਹੋ ਗਏ ਹਨ ਤਾਂ ਮੈਂ ਆਪਣੇ ਬੈਂਕ ਨੂੰ ਫੋਨ ਕਰਕੇ ਉਸ ਬਾਰੇ ਸਪੱਸ਼ਟੀਕਰਨ ਕਰ ਲਵਾਂ ਮੈਂ ਤੁਹਾਡੀ ਬਹੁਤ ਹੀ ਧੰਨਵਾਦੀ ਹੋਵਾਂਗੀ ਅਗਰ ਤੁਸੀਂ ਮੈਨੂੰ ਇਸ ਭੁਗਤਾਨ ਦਾ ਸਫ਼ਲਤਾਪੂਰਵਕ ਹੋਣ ਦਾ ਹੋਣ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਮੈਂ ਤੁਹਾਡੀ ਬਹੁਤ ਹੀ ਧੰਨਵਾਦੀ ਹੋਵਾਂਗੀ